ਸਭ ਤੋਂ ਮਹੱਤਵਪੂਰਨ ਵਿਅੰਜਨ ਮੇਰੇ ਲਈ ਚਿੱਲੀ ਪਨੀਰ ਸੀ ਕਦੇ ਮੇਰੇ ਕੋਲ ਕੜਾਹੀ ਨਹੀਂ ਸੀ ਕਦੇ ਸ਼ਿਮਲਾ ਮਿਰਚਾਂ ਅਤੇ ਕਦੀ ਪਨੀਰ ਫਿਰ ਇਹਦੇ 'ਚ ਪੈਣ ਵਾਲੀਆਂ ਵੱਖਰੀਆਂ ਵੱਖਰੀਆਂ ਸਮੱਗਰੀਆਂ ਦੀ ਕਮੀ ਮੈਂ ਇਸ ਨੂੰ ਬਣਾਉਣ ਵਿੱਚ ਮੈਨੂੰ ਇਸ ਵਿੱਚ ਬਣਾਉਣ ਵਿੱਚ ਬੜੀ ਪ੍ਰੇਸ਼ਾਨੀ ਹੋਈ ਪਰ ਫਿਰ ਵੀ ਮੈਂ ਬਣਾ ਲਿਆ ਫਿਰ ਮੈਂ ਸੋਚਿਆ ਕਿ ਇਸਨੂੰ ਬਣਾਉਣ ਦੀ ਮੈਂ ਕੋਸ਼ਿਸ਼ ਤਾਂ ਕੀਤੀ ਹੈ ਬੜਾ ਸਵਾਦ ਬਣਿਆ ਇਸੇ ਅਨੁਭਵ ਤੋਂ ਮੈਂ ਇਹ ਸਿੱਖਿਆ ਹੈ ਕਿ ਕੋਈ ਵੀ ਨਵੀਂ ਚੀਜ਼ ਸਿੱਖਣਾ ਜ਼ਿਆਦਾ ਔਖਾ ਨਹੀਂ ਹੁੰਦਾ